ਹੈਲੋ ਮੈਮ ਆਪ ਯੂਨੀਵਰਸਿਟੀ ਸੇ ਬਾਤ ਕ ਕਰਦੇ ਪਏ ਹੋ ਹਾਂਜੀ ਮੈਂ ਇੱਥੇ ਬੀ ਐਡ ਕਾਲਜ ਵਿੱਚ ਲੈਕਚਰਾਰ ਹੈਗੀ ਹਾਂ ਹਾਂਜੀ ਮੈਮ ਅਤੇ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਕੋਲਜ ਦੇ ਕਲਾਸਰੂਮ ਦੇ ਸ਼ਡਿਊਲ ਬਾਰੇ ਹਾਂਜੀ ਮੈਮ ਪੁੱਛਣਾ ਸੀ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਪ੍ਰੋਪਰਲੀ ਸ਼ਡਿਊਲ ਹੈ ਨਹੀਂ ਕੁਛ ਬਣਿਆ ਹੋਇਆ ਹਾਂਜੀ ਤਾਂ ਉਸ ਵੇਲੇ ਮੈਂ ਤੁਹਾਨੂੰ ਪੁੱਛਣਾ ਸੀ ਵੀ ਕਿਸ ਤਰ੍ਹਾਂ ਨੈਕਸਟ ਆਏਗਾ ਸ਼ਡਿਊਲ ਅਤੇ ਕੀ ਹੈਗਾ ਹਾਂਜੀ ਹਾਂਜੀ ਹਾਂਜੀ ਮੈਮ ਕਲਾਸਿਸ ਵਿੱਚ ਦਿੱਕਤ ਆ ਰਹੀ ਹੈ ਪਤਾ ਹੀ ਨਹੀਂ ਲੱਗਦਾ ਕਿ ਟਾਈਮਿੰਗ ਦੀ ਵੀ ਕੁਝ ਪਤਾ ਨਹੀਂ ਲੱਗਦਾ ਕਿ ਕਦੋਂ ਹੈਗਾ ਸਾਨੂੰ ਟੀਚਰਸ ਨੂੰ ਅਤੇ ਸਿਲੇਬਸ ਵੀ ਸਾਡਾ ਪ੍ਰੋਪਰਲੀ ਕਵਰ ਨਹੀਂ ਹੋ ਪਾ ਰਿਹਾ ਅਤੇ ਹਾਂਜੀ ਅਤੇ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਮੈਮ ਤੁਸੀਂ ਪਲੀਜ਼ ਥੋੜ੍ਹਾ ਦੇਖਿਓ ਕਿਉਂਕਿ ਪ੍ਰੋਪਰਲੀ ਸ਼ੀਡਿਊਲ ਨਹੀਂ ਪਤਾ ਲੱਗਦਾ ਤਾਂ ਫੇਰ ਟੀਚਰਸ ਨੂੰ ਵੀ ਪ੍ਰੋਬਲਮ ਹੁੰਦੀ ਹੈ ਅਤੇ ਬੱਚਿਆਂ ਨੂੰ ਵੀ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਮੈਮ ਥੋੜ੍ਹਾ ਸਿਲੇਬਸ ਵੀ ਦੇਖਿਓ ਕਿਉਂਕਿ ਕਵਰ ਨਹੀਂ ਹੋ ਪਾਉਂਦਾ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਪਲੀਜ ਤੁਸੀਂ ਦੇਖਿਓ ਅਤੇ ਸਟੈਂਥ ਵੀ ਸਾਡੀ ਪ੍ਰੋਪਰ ਹੈ ਬੱਚਿਆਂ ਦੀ ਬਟ ਟਾਈਮ ਦੇ ਅਕੋਰਡਿੰਗਲੀ ਪਤਾ ਨਹੀਂ ਲੱਗਦਾ ਅਤੇ ਬੱਚੇ ਕਲਾਸ ਵੀ ਨਹੀਂ ਲਗਾ ਸਕਦੇ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਸਿਲੇਬਸ ਦੀ ਪ੍ਰੋਬਲਮ ਮੈਂ ਤਾਂ ਬੁੱਕਸ ਵਗੈਰਾ ਵੀ ਤੁਸੀਂ ਦੇਖ ਲਿਓ ਵੀ ਥੋੜ੍ਹਾ ਈਜ਼ੀ ਆਵੇ ਹਾਂਜੀ ਮੈਮ ਓਕੇ ਮੈਮ ਥੈਂਕ ਯੂ ਸੋ ਮ